ਪੰਜਾਬ ਇੱਕ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਇਤਿਹਾਸ ਹੈ ਗੁਰਦੁਆਰੇ ਮੰਦਰ ਮਸਜਿਦਾਂ ਚਰਚ ਘਰ ਬਹੁਤ ਬਣੇ ਹੋਏ ਹੈ ਅਤੇ ਹਰ ਕੋਈ ਇੱਕ ਦੂਜੇ ਦੇ ਧਰਮ ਦੇ ਰਿਲੇਟਡ ਜਿਵੇਂ ਕਾਲੀ ਮਾਤਾ ਦਾ ਮੰਦਰ ਆ ਗਿਆ ਭੈਰੋਂ ਦਾ ਮੰਦਰ ਆ ਗਿਆ ਅੱਠ ਫੇਸ ਅੰਬ ਸਾਹਿਬ ਗੁਰਦੁਆਰਾ ਆ ਗਿਆ ਹਰਿਮੰਦਰ ਸਾਹਿਬ ਹੈ ਅਤੇ ਦਿਆਲਪੁਰੀ ਮੰਦਰ ਹੈ ਅੰਮ੍ਰਿਤਸਰ ਦੇ ਵਿੱਚ ਬਹੁਤ ਜ਼ਿਆਦਾ ਲੋਕ ਆਪਸ ਦੇ ਵਿੱਚ ਮੇਲ ਮਿਲਾਪ ਰੱਖਦੇ ਹੈ ਆਪਸੀ ਤੇਲ ਮੇਲ ਤਾਲਮੇਲ ਹੈ ਸਾਰੇ ਭਾਈਚਾਰਿਆਂ ਦਾ ਚਰਚ 'ਚ ਵੀ ਜਾਂਦੇ ਆ ਲੋਕ ਚਰਚ ਵਾਲੇ ਗੁਰਦੁਆਰੇ ਸਾਹਿਬ 'ਚ ਵੀ ਜਾਂਦੇ ਆ ਮੰਦਰਾਂ ਵਾਲੇ ਮਸਜਿਦਾਂ 'ਚ ਵੀ ਜਾਂਦੇ ਬਹੁਤ ਪੁਰਾਣੀਆਂ ਮਸਜਿਦਾਂ ਬਣੀਆਂ ਹੋਈਆਂ ਪੰਜਾਬ ਦੇ ਵਿੱਚ ਆਪਸੀ ਭਾਈਚਾਰਕ ਦੀ ਇੱਕ ਬਹੁਤ ਤਕੜੀ ਮਿਸਾਲ ਹੈ ਜਿਹੜੀ ਕਿ ਹੋਰ ਸੂਬਿਆਂ ਦੇ ਵਿੱਚ ਨਹੀਂ ਪਾਈ ਜਾਂਦੀ